ਮੈਂ ਆਪਣੇ ਪੰਜਾਬ ਖੇਤਰ ਤੋਂ ਬਾਹਰ ਬਿਹਾਰ ਦੇ ਵਿੱਚ ਸਥਿਤ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜਨਮ ਅਸਥਾਨ ਸ਼੍ਰੀ ਪਟਨਾ ਸਾਹਿਬ ਦੀ ਯਾਤਰਾ ਕੀਤੀ ਹੈ ਇਸ ਦਾ ਮ ਮਨੁੱਖ ਮ ਮਨੋਰਥ ਆਪਣੇ ਸਿੱਖੀ ਇਤਿਹਾਸ ਨੂੰ ਜਾਨਣਾ ਹੈ ਜੋ ਸਾਡੇ ਗੁਰੂਆਂ ਦੇ ਜਨਮ ਸਥਾਨ ਰਹੇ ਹਨ ਉਹਨਾਂ ਬਾਰੇ ਜਾਨਣਾ ਹੈ ਅਤੇ ਉਥੋਂ ਦੇ ਲੋਕਾਂ ਵਿੱਚ ਸਿੱਖੀ ਸਿਧਾਂਤਾਂ ਨੂੰ ਲੈ ਕੇ ਕੀ ਗਤੀਵਿਧੀਆਂ ਚੱਲਦੀਆਂ ਹਨ ਉਹਨਾਂ ਨੂੰ ਵੇਖਣਾ ਹੈ ਅਤੇ ਜੋ ਸਿਧਾਂਤ ਗੁਰੂ ਸਾਹਿਬਾਨ ਨੇ ਸਾਨੂੰ ਦੱਸੇ ਹਨ ਉਹਨਾਂ 'ਤੇ ਪੂਰਾ ਖਰਾ ਉਤਰਨਾ ਅਤੇ ਉੱਥੋਂ ਦੇ ਲੋਕਾਂ ਦੇ ਹਰ ਰੋਜ਼ ਦੇ ਗੁਜ਼ਰ ਵਸਰ ਨੂੰ ਜਾਨਣਾ ਹੈ ਜਿਸਦੇ ਲਈ ਇਹ ਉਪਰਾਲੇ ਬਹੁਤ ਹਰੇਕ ਸਿੱਖ ਲਈ ਜ਼ਰੂਰੀ ਹਨ